ਅੱਜ ਦੇ ਸੰਸਾਰ ਵਿੱਚ ਪੰਜਾਬੀ ਭਾਸ਼ਾਵਾਂ ਬੋਲਣ ਵਾਲਿਆਂ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਅਤੇ ਜਿਵੇਂ ਕਿ ਪੰਜਾਬ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਹੀ ਬੋਲੀ ਜਾ ਰਹੀ ਹੈ ਅਤੇ ਉਹਨਾਂ ਉਹ ਪੰਜਾਬੀ ਬੋਲੀ ਨੂੰ ਉਸਦੀ ਕੋਈ ਕਦਰ ਨਹੀਂ ਕਰ ਰਿਹਾ ਅਤੇ ਅੱਜ ਕੱਲ੍ਹ ਵਿੱਚ ਹਿੰਦੀ ਜਾਂ ਇੰਗਲਿਸ਼ ਦੀ ਵਰਤੋਂ ਵੱਧ ਕੀਤੀ ਜਾਂਦੀ ਹੈ ਅਤੇ ਇਸ ਲਈ ਸਾਡੇ ਪੰਜਾਬ ਵਿੱਚ ਪੰਜਾਬੀ ਬਹੁਤ ਹੀ ਘੱਟ ਰਹੀ ਹੈ ਤਾਂ ਕਿ ਜਿਸ ਤਾਂ ਕਿ ਸਾਡੀ ਪੰਜਾਬੀ ਬੋਲੀ ਪੰਜਾਬੀ ਬੋਲੀ ਨੂੰ ਬਹੁਤ ਸਾਰੀਆਂ ਚੁਨੌਤੀਆਂ ਇਸ ਲਈ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਦੋਂ ਕੋਈ ਇੰਗਲਿਸ਼ 'ਚ ਗੱਲਬਾਤ ਕਰਦਾ ਹੈ ਅਤੇ ਸਾਡੀ ਪੰਜਾਬੀ ਬੋਲੀ ਨੂੰ ਉਹ ਸਮਝ ਨਹੀਂ ਪਾ ਰਹੇ ਇਸ ਲੀਏ ਸਾਡੀ ਪੰਜਾਬੀ ਬੋ ਮਾਂ ਬੋਲੀ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ

ਕਈ ਵਾਰ ਪੰਜਾਬੀ ਬੋਲੀ ਨੂੰ ਕੋਈ ਵੀ ਸੁਣ ਹੁਣ ਸੁਣ ਨਹੀਂ ਸ ਪਾ ਰਿਹਾ ਅਤੇ ਇਸ ਵਿਚ ਇਸ ਲਈ ਇਸ ਲਈ ਪੰਜਾਬੀ ਮਾਂ ਬੋਲੀ ਪੰਜਾਬੀ ਦੀ ਘੱਟ ਵਰਤੋਂ ਕੀਤੀ ਜਾਂਦੀ ਹੈ ਅਤੇ ਇੰਗਲਿਸ਼ ਜਾਂ ਹਿੰਦੀ ਦੀ ਵਰਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ